ਹੈਲੋ ਮੈਮ ਸਤਿ ਸ਼੍ਰੀ ਅਕਾਲ ਮੈਮ ਮੈਂ ਮੋਨਿਕਾ ਬੋਲਦੀ ਹਾਂ ਪਿੰਡ ਰੈਲ ਮਾਜਰੇ ਤੋਂ ਮੈਮ ਤੁਸੀਂ ਅਮਨ ਕੈਂਟਰੀ ਤੋਂ ਬੋਲਦੇ ਹੋ ਅੱਛਾ ਜੀ ਇਹ ਵੀ ਠੀਕ ਹੈ ਮੇਰੇ ਬ੍ਰਦਰ ਦੀ ਮੈਰਿਜ ਹੈ ਮੈਂ ਕੁਝ ਨਾ ਸਮਾਨ ਵਗੈਰਾ ਆਰੇਂਜਮੈਂਟ ਕਰਵਾਣੀ ਚਾਹੁੰਦੀ ਹਾਂ ਤੁਸੀਂ ਇੱਥੇ ਕਰਵਾ ਸਕਦੇ ਆ ਮੈਮ ਸਾਨੂੰ ਨਾ ਹਜ਼ਾਰ ਤੋਂ ਉੱਪਰ ਮਤਲਬ ਮਹਿਮਾਨ ਆ ਸਕਦੇ ਆ ਸਾਨੂੰ ਉਹਨਾਂ ਦੀ ਪਲੇਟਾਂ ਚਾਹੀਦੀਆਂ ਏ ਹਾਂਜੀ ਉਸ ਪਲੇਟ ਦੇ ਵਿੱਚ ਕਿਆ ਕਿਆ ਡਿਸ਼ਜਿਜ਼ ਵਗੈਰਾ ਹੋ ਸਕਦੀਆਂ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਵਿਚ ਮਤਲਬ ਮਠਿਆਈ ਵਗੈਰਾ ਵੀ ਚਾਹੀਦੀ ਹੈ ਸਾਨੂੰ ਠੀਕ ਹੈ ਜੀ ਹਾਂਜੀ ਅਤੇ ਹੋਰ ਮਤਲਬ ਅਸੀਂ ਜੋ ਆਪਣੇ ਕੋਲੋਂ ਵੀ ਕੁਝ ਅਲੱਗ ਚੀਜ਼ ਤੋਂ ਸਮਾਨ ਪਵਾਉਣਾ ਚਾਹੁੰਦੇ ਹਾਂ ਉਹ ਵੀ ਵਿੱਚ ਪੈ ਸਕਦਾ ਹੈ ਅੱਛਾ ਜੀ ਕਿੰਨੇ ਕੁ ਤੱਕ ਵਧ ਸਕਦਾ ਅੱਛਾ ਜੀ ਕੁਝ ਜ਼ਿਆਦਾ ਨਹੀਂ ਆ ਰੇਟ ਵਗੈਰਾ ਅੱਛਾ ਜੀ ਅਤੇ ਸਾਨੂੰ ਚਾਵਲ ਮਤਲਬ ਬਾਸਮਤੀ ਚਾਵਲ ਹਾਂਜੀ ਸਾਨੂੰ ਤਿੰਨ ਤਰ੍ਹਾਂ ਦੇ ਚਾਵਲ ਚਾਹੀਦੇ ਨੇ ਬਾਸਮਤੀ ਚਾਵਲ ਵਾਈਟ ਹੋਵੇ ਹਾਂਜੀ ਵਿੱਚ ਮਤਲਬ ਅਲੱਗ ਤੋਂ ਵਾਈਟ ਚਾਵਲ ਜ਼ੀਰਾ ਟਰਾਈਸ ਹੋਣੇ ਚਾਹੀਦੇ ਹਾਂਜੀ ਸਬਜ਼ੀ ਦੇ ਵਿੱਚ ਸਾਨੂੰ ਉਹ ਵੀ ਚਾਹੀਦੇ ਆ ਜ਼ੀਰਾ ਆਲੂ ਜ਼ੀਰਾ ਵਗੈਰਾ ਇੱਦਾਂ ਦੀਆਂ ਚੀਜਾਂ ਕੁਝ ਠੀਕ ਹੈ ਜੀ ਅਤੇ ਮੈਂ ਅਲੱਗ ਤੋਂ ਕੁਝ ਕਰਵਾਉਣਾ ਚਾਹੁੰਦੇ ਆ ਅਸੀਂ ਉਹ ਵੀ ਹੋ ਸਕਦਾ ਹੈ ਠੀਕ ਹੈ ਜੀ ਮੈਂ ਡੈਕੋਰੇਸ਼ਨ ਤ ਵਗੈਰਾ ਕਰਵਾਉਣੀ ਆ ਆਪਣੇ ਭਰਾ ਦੀ ਮੈਰਿਜ ਹੈ

ਓਕੇ ਜੀ ਹਾਂਜੀ ਥੈਂਕ ਯੂ ਮੈਮ ਹਾਂਜੀ ਮੈਂ ਤੁਹਾਨੂੰ ਫੋਨ ਕਰਕੇ ਦੱਸ ਦੂਗੀ

ਠੀਕ ਹੈ ਜੀ ਥੈਂਕ ਯੂ ਜੀ